ਹੈਲੋ ਹਾਂਜੀ ਸਰ ਹਾਂਜੀ ਸਰ ਉਹ ਮੈਂ ਕੀਤਾ ਸੀ ਉਹਦੇ ਵਾਸਤੇ ਫੋਨ ਬਈ ਇਹ ਮੈਨੂੰ ਪਤਾ ਲੱਗਿਆ ਵੀ ਤੁਸੀਂ ਅੱਜ ਕੱਲ੍ਹ ਕੋਈ ਰਾਈਟ ਲਿਖਦੇ ਹੋ ਅਤੇ ਸਰ ਕੀ ਸ਼ੌਂਕ ਆ ਆਪਣਾ ਲਿਖਣ ਦਾ ਕਵਿਤਾ ਲਿਖਦੇ ਹੋ ਠੀਕ ਹੈ ਸਰ ਅਤੇ ਅੱਛਾ ਅੱਛਾ ਅੱਛਾ ਅੱਛਾ ਅੱਛਾ ਸਰ ਮੈਂ ਮੈਂ ਮੈਂ ਸਰ ਉਹ ਐਮਫਿਲ ਕੀਤੀ ਆ ਪੰਜਾਬੀ 'ਚ ਅਤੇ ਮੇਰਾ ਸ਼ੌਂਕ ਸੀ ਮੈਂ ਐਮਫਿਲ ਕੀਤੀ ਸੀ ਕਿੱਸਾ ਪੂਰਨ ਭਗਤ ਦੇ ਬਾਰੇ ਕੀਤੀ ਸੀ ਉਹ ਨਾ ਫਿਫਟੀ ਫ਼ੋਰ ਕਵੀਆਂ ਨੇ ਲਿਖਿਆ ਹੋਇਆ ਅੱਜ ਤੱਕ ਅਤੇ ਉਹਦੇ ਉੱਤੇ ਮੇਰਾ ਨਾ ਕੰਪੈਰੀਜ਼ਨ ਸੀ ਤੁਲਨਾਤਮਕ ਅਧਿਐਨ ਅਤੇ ਉਹਦੇ ਉੱਤੇ ਸਰ ਮੈਨੂੰ ਬੜਾ ਮਜ਼ਾ ਆਇਆ ਕਿੱਸਾ ਪੜ੍ਹਨ ਦਾ ਕਿੱਸਾ ਕਿਉਂਕਿ ਤੁਹਾਨੂੰ ਪਤਾ ਵੀ ਕਾਦਰਯਾਰ ਦਾ ਬੜਾ ਮਸ਼ਹੂਰ ਕਿੱਸਾ ਪੂਰਨ ਭਗਤ ਦਾ ਪਰ ਮੈਂ ਮੈਂ ਕੀਤੀ ਹੈ ਜੰਮੂ ਯੂਨੀਵਰਸਿਟੀ ਅਤੇ ਉੱਥੇ ਨਾ ਇੱਕ ਰਾਮਧਨ ਕਵੀ ਹੋਇਆ ਉਹਦੇ ਉਨ ਉਹਦੇ ਵਿੱਚ ਵੀ ਬਈ ਉਹਨੇ ਤੇ ਉਹਨੇ ਕੀ ਬਖਤਾ ਲਿਆਉਂਦੀ ਕਿੱਸੇ ਦੇ ਲਿਖਣ 'ਚ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਅਤੇ ਸਰ ਉਹਦੇ ਵਿੱਚ ਉਹਨਾਂ ਨੇ ਜਿੱਦਾਂ ਕੋਈ ਕੀਤਾ ਓਏ ਕਾਦਰਯਾਰ ਨੇ ਪੰਜ ਛੇ ਹਰਫੀਆਂ 'ਚ ਲਿਖਿਆ ਉਹਨੇ ਸੱਤ ਛੇ ਹਰਫੀਆਂ 'ਚ ਲਿਖਿਆ ਉਹਨੂੰ ਹੁਣ ਛੇ ਹਰਫੀ ਕਹਿ ਲਈਏ ਵੀ ਹਾਂਜੀ ਹਾਂਜੀ ਹਾਂਜੀ ਸਰ

ਹਾਂਜੀ ਹਾਂਜੀ ਸਰ ਹਾਂਜੀ ਲਿਖਦੇ ਰਹੀਦਾ ਸਰ ਸਰ ਜ਼ਰੂਰ ਸੁਣਾਵਾਂਗੇ ਮੇਰੇ ਐਕਚੁਲੀ ਮੇਰੇ ਨਾ ਫਾਦਰ ਇੰਨ ਲਾਅ ਆ ਉਹ ਰਾ ਉਹ ਉਹ ਆ ਨਾ ਉਹ ਗਜ਼ਲਕਾਰ ਨੇ ਉਹ ਤੁਹਾਡੇ ਬਟਾਲੇ ਤੋਂ ਹੀ ਨੇ ਰਾਹੀਂ ਬਟਾਲਵੀ ਜਾਣਦੇ ਹੋ ਅੱਛਾ ਅਤੇ ਭੁਪਿੰਦਰ ਸਿੰਘ ਪੰਛੀ ਹੈ ਮੁੰਡਾ ਉਹਨੂੰ ਜਾਣਦੇ ਹੋ ਹਾਂ ਉਹ ਮੇਰਾ ਕਲਾਸ ਫੈਲੋ ਹੈ ਐਮਫਿਲ ਆਪਾਂ ਇਕੱਠੇ ਕੀਤੀ ਆ ਅਤੇ ਹਾਲ ਹੀ ਵਿੱਚ ਇੱਥੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਪਠਾਨਕੋਟ ਜ਼ਿਲ੍ਹੇ 'ਚ ਡਾਕਟਰ ਸੁਰੇਸ਼ ਮਹਿਤਾ ਭਾਸ਼ਾ ਅਫਸਰ ਅੱਜ ਕੱਲ੍ਹ ਉਹ ਅੰਮ੍ਰਿਤਸਰ ਚੱਲ ਗਏ ਹੈ ਕੱਲ੍ਹ ਦੇ ਕੱਲ੍ਹ ਉਹਨਾਂ ਦੀ ਪੋਸਟਿੰਗ ਹੋ ਗਈ ਆ ਉੱਧਰ ਅਤੇ ਮੈਂ ਸਰ ਮੈਂ ਉਹ ਇਹ ਪੰਜਾਬੀ ਟੀ ਪੰਜਾਬੀ ਦੇ ਟੀਚਰ ਤਾਂ ਨਹੀਂ ਬਣ ਸਕਿਆ ਪਰ ਮੈਂ ਨਾ ਈ ਟੀ ਟੀ ਟੀਚਰ ਹਾਂ ਹਾਂਜੀ ਅਤੇ ਮੇਰਾ ਵਧੀਆ ਸਰ ਠੀਕ ਚੱਲ ਪਿਆ ਵਧੀਆ ਮੈਨੂੰ ਇਹ ਸਕੂਨ ਮਿਲਿਆ ਮਜ਼ਾ ਆਇਆ ਅਤੇ ਮੈਂ ਤੁਹਾਨੂੰ ਇੱਕ ਦੋ ਸ਼ੇਅਰ ਟਾਈਮ ਤਾਂ ਨਹੀਂ ਹੈ ਪਰ ਮੈਂ ਸੁਣਾਉਂਦਾ ਅਤੇ ਹਾਂਜੀ ਹਾਂਜੀ

ਚੱਲੋ ਸਰ ਉਹ ਫਿਰ ਬਾਅਦ 'ਚ ਹੀ ਸੁਣਾਉਂਦਾ ਮੈਂ ਤੁਹਾਨੂੰ ਮੁੜ ਕੇ ਕਰਦਾ ਫੋਨ